ਤੇਰਾਂ ਮਾਰਚ ਉੱਨੀ ਸੌ ਸੱਤਰ ਇੱਕ ਨਵੰਬਰ ਉੱਨੀ ਸੌ ਅੱਸੀ ਅੱਠ ਦਸੰਬਰ ਦੋ ਹਜ਼ਾਰ ਅੱਠ ਸੋਲ੍ਹਾਂ ਜੂਨ ਦੋ ਹਜ਼ਾਰ ਬਾਰਾਂ ਬਾਰਾਂ ਅਗਸਤ ਦੋ ਹਜ਼ਾਰ ਉੱਨੀ